ਰੋਪੜ ਦੇ ਵਿੱਚ ਗੌਰਮਿੰਟ ਕਾਲਜ ਰੌਪੜ ਹੈ ਜਿਸ ਦੇ ਵਿੱਚ ਮੇਰੀ ਬੇਟੀ ਬੀਐੱਸਸੀ ਨੋਨ ਮੈਡੀਕਲ ਤੋਂ ਕਰ ਰਹੀ ਏ ਬੇਲਾ ਕਾਲਜ ਹੈ ਖਾਲਸਾ ਕਾਲਜ ਅਨੰਦਪੁਰ ਸਾਹਿਬ ਹੈ ਦੁਆਬਾ ਔਰ ਰਿਆਤ ਬਹਾਰਾ ਹੈ ਖਰੜ ਦੇ ਵਿੱਚ ਬੀਬੀ ਸ਼ਰਨ ਕੌਰ ਕਾਲਜ ਚਮਕੌਰ ਸਾਹਿਬ 'ਚ ਏ